ਮੇਰਾ ਉਸ ਟਾਈਮ ਦਾ ਮਹੱਤਵਪੂਰਨ ਫੈਸਲਾ ਸੀ ਕਿ ਜਦੋਂ ਮੇਰਾ ਵਿਆਹ ਹੋਣਾ ਸੀ ਅਤੇ ਮੈਂ ਆਪਣੇ ਘਰਦਿਆਂ ਦੀ ਸਲਾਹ ਲਈ ਕਿ ਮੁੰਡਾ ਕਿਵੇਂ ਦਾ ਅਤੇ ਹੋਣਾ ਚਾਹੀਦਾ ਹੈ ਅਤੇ ਮੇਰੇ ਘਰਦਿਆਂ ਨੇ ਵਧੀਆ ਸਲਾਹ ਦਿੱਤੀ ਅਤੇ ਵਧੀਆ ਮੁੰਡੇ ਨਾਲ ਮੇਰਾ ਵਿਆਹ ਹੋ ਚੁੱਕਿਆ